ਪੰਜਾਬ ਦੇ ਜਿਹੜੇ ਪ੍ਰਮੁੱਖ ਸਰਕਾਰੀ ਵਿਭਾਗ ਜਾ ਏਜੰਸੀਆਂ ਹਨ ਉਹ ਮੇਨ ਹੈਗੇ ਜਿੱਦਾਂ ਸਿੱਖਿਆ ਸਿਹਤ ਬੁਨਿਆਦੀ ਢਾਂਚਾ ਨਿਆਂ ਜਿਹਨੂੰ ਲਾਅ ਐਂਡ ਆਰਡਰ ਵੀ ਕਹਿ ਦਿੰਦੇ ਆ ਤਾਂ ਇਹਨਾਂ ਦੇ ਜਿਹੜੇ ਮੇਨ ਮੇਨ ਕੰਮ ਆ ਨੇ ਉਹ ਸਿੱਖਿਆ ਵਿਭਾਗ ਹੈ ਜਿਹੜਾ ਉਹ ਸਾਰੇ ਪ੍ਰਾਇਮਰੀ ਹਾਈ ਅਤੇ ਉਸ ਤੋਂ ਉਚੇਰੀ ਸਿੱਖਿਆ ਬਾਰੇ ਰੂਲ ਬਣਾਉਂਦੇ ਨੇ ਸਕੂਲ ਕਾਲਜ ਬਣਾਉਂਦੇ ਨੇ ਉਹਨਾਂ ਨੂੰ ਚਲਾਉਂਦੇ ਨੇ ਅਤੇ ਜਿਹੜਾ ਸਿਹਤ ਵਿਭਾਗ ਹੈ ਉਹ ਜਿਹੜਾ ਜਿੰਨੇ ਵੀ ਮਰੀਜ਼ ਆ ਉਹਨਾਂ ਲਈ ਸਰਕਾਰੀ ਹਸਪਤਾਲ ਖੋਲਦੇ ਆ ਉਹਨਾਂ 'ਚ ਡਾਕਟਰ ਦੀ ਟੈਸਟਾਂ ਦੀ ਪ੍ਰਬੰਧ ਕਰਦੇ ਨੇ ਅਤੇ ਜਿਹੜਾ ਬੁਨਿਆਦੀ ਢਾਂਚਾ ਉਹ ਸਾਡਾ ਜਿਹੜਾ ਬਾਕੀ ਜਿਹੜਾ ਹੈਗਾ ਇਨਫਰਾਸਟਰਕਚਰ ਵਗੈਰਾ ਉਹ ਡਿਵੈਲਪ ਕਰਦੇ ਨੇ ਜਿਹੜੇ ਨਿਆਂ ਵਾਲੇ ਆ ਉਹ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਉਹ ਦੇਖਦੇ ਨੇ ਤਾਂ ਕਿ ਕਿਸੇ ਨਾਲ ਜੇ ਕੋਈ ਅਨਜਸਟਿਸ ਹੋ ਰਿਹਾ ਤਾਂ ਉਸ ਨੂੰ ਜਿਹੜਾ ਨਿਆਂ ਦਿਵਾਇਆ ਜਾ ਸਕੇ ਉਹਦੇ ਲਈ ਕੋਰਟ ਵਕੀਲ ਅਦਾਲਤਾਂ ਸਰਕਾਰ ਜਿਹੜੀ ਹੈ ਉਹਨਾਂ ਦਾ ਪ੍ਰਬੰਧ ਕਰਦੀ ਹੈ ਅਤੇ ਇਸ ਤੋਂ ਬਿਨਾਂ ਜਿਵੇਂ ਕਲਚਰਲ ਅਫੇਅਰ ਅਤੇ ਟੂਰਿਜਮ ਡਿਪਾਰਟਮੈਂਟ ਵਗੈਰਾ ਵੀ ਹੈਗੇ ਆ ਉਹ ਫਿਰ ਸੈਰ ਸਪਾਟਾ ਅਤੇ ਟੂਰਜਮ ਬਾਰੇ ਜਿਹੜਾ ਪ੍ਰਬੰਧ ਕਰਦੇ ਨੇ ਅਤੇ ਫੂਡ ਅਤੇ ਸਿਵਲ ਸਪਲਾਈ ਵਾਲੇ ਨੇ ਉਹ ਲੋਕਾਂ ਲਈ ਫੂਡ ਦੇ ਨਾਲ ਸੰਬੰਧਿਤ ਜਿਹੜੇ ਨਿਯਮ ਬਣਾਉਂਦੇ ਨੇ ਤਾਂ ਕਿ ਲੋਕਾਂ ਨੂੰ ਠੀਕ ਸਟੈਂਡਰਡ ਦਾ ਠੀਕ ਕੁਆਲਿਟੀ ਦਾ ਫੂਡ ਮਿਲੇ ਅਤੇ ਜਿੰਨੇ ਵੀ ਰੈਸਟੋਰੈਂਟ ਢਾਬੇ ਨੇ ਉਹਨਾਂ ਦੇ ਉੱਤੇ ਕਾਨੂੰਨ ਉਹ ਲੱਗਦੇ ਹੈਗੇ ਆ ਜਿਹੜੇ ਵੀ ਫੂਡ ਸੇਫਟੀ ਐਕਟ ਹੈਗੇ ਆ ਅਤੇ ਦੂਸਰਾ ਉਹ ਫਿਰ ਜਦੋਂ ਵੀ ਫਸਲ ਆਉਂਦੀ ਹੈ ਅਤੇ ਉਸ ਤੋਂ ਉੱਪਰ ਪਰਕਿਊਰਮੈਂਟ ਜਾਂ ਖਰੀਦ ਵਗੈਰਾ ਕਰਦੇ ਆ ਤਾਂਕਿ ਇਨ ਫਿਊਚਰ ਦੇ ਵਿੱਚ ਉਹਨੂੰ ਸਟੋਕ ਕਰਕੇ ਰੱਖਿਆ ਜਾ ਸਕੇ ਧੰਨਵਾਦ